ਹੈਲੋ ਵਧੀਆ ਤੁਸੀਂ ਦੱਸੋ ਜੀ ਮੈਮ ਹਾਂਜੀ ਹਾਂਜੀ ਘਰ ਸਭ ਵਧੀਆ ਤੁਸੀਂ ਦੱਸੋ ਘਰ ਸਭ ਠੀਕ ਹੈ ਹਾਂਜੀ ਹਾਂਜੀ ਹਾਂਜੀ ਮੈਡਮ ਮੈਮ ਫਿਰ ਹੁਣ ਆਪਾਂ ਵਰਕਸ਼ੀਟਸ ਬਣਾ ਲੈਂਦੇ ਹਾਂ ਜਾਂ ਔਨਲਾਈਨ ਕਲਾਸਾਂ ਲਾ ਲੈਂਦੇ ਹਾਂ ਹਾਂਜੀ ਹਾਂਜੀ ਇਹ ਤਾਂ ਹੈਗਾ ਅਤੇ ਔਨਲਾਈਨ ਕਲਾਸਾਂ ਦਾ ਟਾਈਮ ਟੇਬਲ ਬਣਾ ਲੈਂਦੇ ਹਾਂ ਅੱਛਾ ਠੀਕ ਹੈ ਮੈਮ ਅਤੇ ਤੁਸੀਂ ਮੈਨੂੰ ਕਦੋਂ ਕੁ ਤੱਕ ਟਾਈਮ ਟੇਬਲ ਸੈਂਡ ਕਰ ਦੋਗੇ ਅੱਛਾ ਹਾਂਜੀ ਹਾਂਜੀ ਫਿਰ ਅੱਜ ਨੋਟਸ ਵੀ ਬਣਾਉਣੇ ਪੈਣੇ ਆ ਨਾ ਹਾਂਜੀ ਹਾਂਜੀ ਹਾਂਜੀ ਚੱਲੋ ਮੈਨੂੰ ਤੁਸੀਂ ਜਿਵੇਂ ਵੀ ਹੋਇਆ ਦੱਸ ਦਿਓ ਜੇ ਕੱਲ੍ਹ ਕਲਾਸਾਂ ਲਾਉਣੀ ਹੈ ਤਾਂ ਮੈਂ ਹੁਣੇ ਨੋਟਸ ਸਾਰੇ ਪ੍ਰਿਪੇਅਰ ਕਰ ਲੈਂਦੀ ਹਾਂ ਸਾਰਾ ਡਾਟਾ ਕਲੈਕਟ ਕਰ ਲੈਂਦੀ ਹਾਂ ਮੈਂ ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ ਇਹ ਤਾਂ ਹੈਗਾ ਹਾਂਜੀ ਤੁਸੀਂ ਕਰ ਲਓ ਜਿਵੇਂ ਹੁੰਦਾ ਠੀਕ ਹੈ ਮੈਮ ਓਕੇ ਓਕੇ ਮੈਮ ਥੈਂਕ ਯੂ ਬਾਏ